ਸਾਡੇ ਘਰ ਦੇ ਬਾਹਰ ਇੱਕ ਆਲ੍ਹਣਾ ਸੀ ਆਲ੍ਹਣੇ ਵਿੱਚ ਨਾ ਪੰਛੀ ਨੇ ਆਪਣੇ ਬੱਚੇ ਦਿੱਤੇ ਹੋਏ ਸੀ ਅਤੇ ਜਦੋਂ ਪੰਛੀ ਥੋੜ੍ਹੇ ਜਿਹੇ ਵੱਡੇ ਹੋ ਗਏ ਅਤੇ ਇੱਕ ਜਿਹੜਾ ਪੰਛੀ ਹੈ ਉਹ ਨੀਚੇ ਗਿਰ ਗਿਆ ਉਸ ਨੂੰ ਦੇਖ ਕੇ ਸਾਰੇ ਕੁੱਤੇ ਭੌਂਕਣ ਲੱਗ ਗਏ ਪੰਛੀ ਡਰਿਆ ਅਤੇ ਸਹਿਮਿਆ ਜਿਹਾ ਸੀਗਾ ਉਹਦਾ ਅਲੱਗ ਜਿਹਾ ਵਤੀਰਾ ਸੀ ਬਾਕੀ ਪੰਛੀ ਉੱਡ ਰਹੇ ਸਨ ਮੈਂ ਚੁੱਕ ਕੇ ਉਹਨੂੰ ਅੰਦਰ ਲਿਆਉਂਦਾ ਅਤੇ ਉਹਦੀ ਉਹਦੀ ਸੰਭਾਲ ਕੀਤੀ ਅਤੇ ਉਹਨੂੰ ਪਾਣੀ ਪੁਣੀ ਪਿਲਾ ਕੇ ਉਡਾ ਦਿੱਤਾ ਧੰਨਵਾਦ